ਪੰਜਾਬੀ ਭਾਸ਼ਾ ਵਿੱਚ ਖੜਵੇ ਸ਼ਬਦ ਪਾਏ ਜਾਂਦੇ ਹਨ ਜਿਵੇਂ ਕਿ ਣਾਣਾ ਅਤੇ ੜਾੜਾ ਜੋ ਕਿ ਹੋਰ ਭਾਸ਼ਾਵਾਂ ਵਿੱਚ ਘੱਟ ਪਾਏ ਜਾਂਦੇ ਹਨ